ਮੈਂ ਇੱਕ ਘੜੀ ਖਰੀਦਣਾ ਚਾਹੁੰਦੀ ਸੀ ਇਸ ਕਰਕੇ ਮੈਂ ਫਲਿੱਪਕਾਰਡ 'ਤੇ ਔਨਲਾਈਨ ਸਮਾਰਟ ਵਾਚਿਸ ਸਰਚ ਕੀਤੀਆਂ ਉੱਥੋਂ ਮੈਨੂੰ ਇੱਕ ਘੜੀ ਬਹੁਤ ਜ਼ਿਆਦਾ ਪਸੰਦ ਆਈ ਉਸ ਦਾ ਬਹੁਤ ਸੋਹਣਾ ਰੰਗ ਸੀ ਅਤੇ ਉਸਨੂੰ ਮੈਂ ਔਨਲਾਈਨ ਔਡਰ ਕਰ ਦਿੱਤਾ ਅਤੇ ਉਸ ਦੇ ਨਾਲ ਹੀ ਔਨਲਾਈਨ ਪੇਮੈਂਟ ਵੀ ਉਸ ਦੀ ਕਰ ਦਿੱਤੀ ਅਤੇ ਜਦੋਂ ਉਹ ਔਡਰ ਮੈਨੂੰ ਮਿਲਿਆ ਤਾਂ ਮੈਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਮੇਰਾ ਮਨ ਬਹੁਤ ਖਰਾਬ ਹੋਇਆ ਅਸਲ ਦੇ ਵਿੱਚ ਉਹ ਘੜੀ ਆ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਨਿੱਕਲੀ ਸੀ ਉਸਦਾ ਰੰਗ ਬਿਲਕੁਲ ਹੀ ਬਦਲਿਆ ਹੋਇਆ ਸੀ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ ਤਾਂ ਮੇਰੇ ਮਨ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਤਾਂ ਇਸ ਕਰਕੇ ਮੈਂ ਉਹ ਜਿਹੜੀ ਘੜੀ ਹੈਗੀ ਹੁਣ ਉਹ ਵਾਪਿਸ ਕਰ ਦਿੱਤੀ ਹੈ